ਸਾਡੇ ਰਾਜ ਅਤੇ ਦੇਸ਼ ਬਾਰੇ ਜਾਣਨ ਦੇ ਵਿੱਚ ਇੰਟਰਨੈਟ ਨੇ ਬਹੁਤ ਸਾਰੀ ਮਦਦ ਕੀਤੀ ਹੈ ਜਿਵੇਂ ਕਿ ਸਾਨੂੰ ਕੋਈ ਵੀ ਸਕੀਮ ਸਕਾਮ ਬਾਰੇ ਪਤਾ ਨਹੀਂ ਲੱਗਦਾ ਤਾਂ ਅਸੀਂ ਉਹ ਇੰਟਰਨੈਟ ਦੇ ਉੱਤੇ ਸਰਚ ਮਾਰ ਕੇ ਦੇਖ ਸਕਦੇ ਹਾਂ ਸਾਡੇ ਰਾ ਰਾਜ ਦੇ ਵਿੱਚ ਜਿਵੇਂ ਕਿ ਸਤਲੁਜ ਜੇਹਲਮ ਰਾਵੀ ਬਿਆਸ ਚਨਾਬ ਸਰਸਵਤੀ ਇੰਡਸ ਦਰਿਆ ਵਹਿੰਦੇ ਸੀਗੇ ਜਿਹੜੀ ਪੰਜਾਬ ਦੀ ਸਰਹੱਦ ਹੈਗੀ ਕਈ ਦੇਸ਼ਾਂ ਦੇ ਨਾਲ ਜਿਹੜੀ ਪੰਜਾਬ ਦੀ ਸਰਹੱਦ ਹੈ ਉਹ ਸਾਂਝੀ ਹੈਗੀ ਪੰਜਾਬ ਦੀ ਜਿਹੜੀ ਸਰਹੱਦ ਹੈ ਪੱ ਪੱਛਮ ਵੱਲ ਪਾਕਿਸਤਾਨ ਦੇ ਪੰਜਾਬ ਸੂਬੇ ਉੱਤਰ ਵੱਲੋਂ ਜੰਮੂ ਅਤੇ ਕਸ਼ਮੀਰ ਉੱਤਰ ਪੂਰਬ ਵੱਲ਼ ਹਿਮਾਚਲ ਪ੍ਰਦੇਸ਼ ਅਤੇ ਦੱਖਣ ਵੱਲ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਲੱਗਦੀ ਹੈਗੀ ਇਸ ਤਰ੍ਹਾਂ ਅਸੀਂ ਇੰਟਰਨੈਟ ਤੋਂ ਦੇਸ਼ ਅਤੇ ਰਾਜ ਬਾਰੇ ਕੁਛ ਕੁਛ ਵੀ ਪ੍ਰਾਪਤ ਕਰ ਸਕਦੇ ਹਾਂ ਜੋ ਕਿ ਸਾਨੂੰ ਜਿਹਦੀ ਜਾਣਕਾਰੀ ਨਹੀਂ ਹੈ ਉਹ ਵੀ ਦੇਖ ਸਕਦੇ ਹਾਂ ਇਸ ਤਰ੍ਹਾਂ ਅਸੀਂ ਇੰਟਰਨੈਟ ਤੋਂ ਜਾਣਕਾਰੀ ਬਹੁਤ ਹੀ ਹੋਰ ਕੁਛ ਜੋ ਕੁਛ ਨਹੀਂ ਪਤਾ ਉਹਨਾਂ ਬਾਰੇ ਪ੍ਰਾਪਤ ਕਰ ਸਕਦੇ ਹਾਂ